ਮੈਂ ਭਵਿੱਖ ਦੀ ਟਕਨੋਲਜੀ ਨੂੰ ਜੀਵਨ ਬਿਹਤਰ ਬਣਾਉਣ ਵਾਲੇ ਉੱਤਮ ਉਧਿਅਮ ਵਜੋਂ ਦੇਖਦਾ ਹਾਂ ਇਹ ਉੱਚ ਸੁਰੱਖਿਆ ਮਿਆਰ ਹਾਏ ਸਟੈਂਡਰਡ ਓਫ ਸਕਿਓਰਿਟੀ ਦੇ ਨਾਲ ਡੇਟਾ ਅਤੇ ਨਿੱਜਤਾਂ ਦੀ ਰੱਖਿਆ ਕਰੇਗੀ ਵਧੀਕ ਉਤਪਾਦਕਤਾ ਇਨਹਾਂਸ ਪ੍ਰੋਡਕਟੀਵਿਟੀ ਤੋਂ ਕੰਮ ਤੇਜ਼ ਅਤੇ ਆਸਾਨ ਹੋਵੇਗਾ ਸਿੱਖਿਆ ਖੇਤਰ ਵਿੱਚ ਨਵੇਂ ਮੌਕੇ ਬੈਟਰ ਓਪਰਚੂਨਿਟੀਸ ਫੋਰ ਲਰਨਿੰਗ ਖੁੱਲ੍ਹਣਗੇ ਜਿੱਥੇ ਏ ਆਏ ਅਤੇ ਵਰਚੁਅਲ ਰਿਐਲਿਟੀ ਸਿੱਖਣ ਦੇ ਨਵੇਂ ਢੰਗ ਪੈਦਾ ਕਰਨਗੇ ਇਹ ਟੈਕਨੋਲਜੀ ਨਾ ਸਿਰਫ ਉੱਨਤੀ ਲਾਵੇਗੀ ਸਗੋਂ ਨਵੀਆਂ ਸੰਭਾਵਨਾ ਖੋਲ੍ਹੇਗੀ